ਬਹੁਤ ਸਾਰੀਆਂ ਤਕਨੀਕੀ ਸਮੱਸਿਆਵਾਂ ਹਨ ਜੋ ਕਿ ਨਾ ਸਿਰਫ਼ ਮਨੁੱਖ ਬਲਕਿ ਜਾਨਵਰਾਂ ਅਤੇ ਪੰਛੀਆਂ ਉੱਪਰ ਵੀ ਬੁਰਾ ਪ੍ਰਭਾਵ ਪਾ ਰਹੀਆਂ ਹਨ ਉਦਾਹਰਣ ਵਜੋਂ ਫਾਈਵ ਜੀ ਟਾਵਰ ਲੱਗਣ ਦੇ ਕਾਰਨ ਪੰਛੀਆਂ ਦੇ ਉੱਪਰ ਸਿੱਧਾ ਅਸਰ ਪੈ ਰਿਹਾ ਹੈ ਜੀ ਇਹਦੇ ਨਾਲ ਵਾਤਾਵਰਣ ਵਿੱਚ ਖ਼ਤਰਨਾਕ ਕਿਰਨਾ ਵੀ ਫੈਲ ਰਹੀਆਂ ਹਨ ਇਸ ਤੋਂ ਇਲਾਵਾ ਤਕਨੀਕੀ ਯੰਤਰ ਉਦਾਹਰਣ ਵਜੋਂ ਮੋਬਾਈਲ ਫੋਨ ਜਿਨ੍ਹਾਂ ਦੀ ਮਨੁੱਖ ਅੰਧਾ ਧੁਨ ਵਰਤੋਂ ਕਰ ਰਿਹਾ ਹੈ ਜਿਸ ਨਾਲ ਉਸਦਾ ਕੀਮਤੀ ਸਮਾਂ ਵਿਅਰਥ ਜਾ ਰਿਹਾ ਹੈ ਅਤੇ ਇਸ ਨਾਲ ਬਹੁਤ ਸਾਰੇ ਫਰੋਡ ਵੀ ਹੋ ਰਹੇ ਹਨ